ਦੋ ਫਰਵਰੀ ਦੋ ਹਜ਼ਾਰ ਚਾਰ ਅੱਠ ਦਸੰਬਰ ਦੋ ਹਜ਼ਾਰ ਅੱਠ ਇੱਕ ਫਰਵਰੀ ਦੋ ਹਜ਼ਾਰ ਦੋ ਸੱਤ ਫਰਵਰੀ ਦੋ ਹਜ਼ਾਰ ਛੇ ਅੱਠ ਫਰਵਰੀ ਦੋ ਹਜ਼ਾਰ ਇੱਕੀ